ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਹੋਰ ਕਿਵੇਂ ਹੋ ਜੀ ਹਾਂਜੀ ਉਹ ਭਾਜੀ ਮੈਂ ਨਾ ਐਕਚੂਅਲੀ ਵਜਣ ਜਿਹਾ ਘਟਾਉਣਾ ਸੀ ਮੈਂ ਤੁਹਾਨੂੰ ਪੁੱਛ ਰਿਹਾ ਸੀ ਵੀ ਕਿਹੜੀ ਅਕੈਡਮੀ ਬੈਸਟ ਰਹੇਗੀ ਆਪਣੇ ਲਈ ਠੀਕ ਹੈ ਜੀ ਠੀਕ ਠੀਕ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਭਾਜੀ ਅਤੇ ਡਾਇਟ ਚਾਰਟ ਦੇਣਗੇ ਜੀ ਜਿਵੇਂ ਕਿ ਖਾਣ ਪੀਣ ਨੂੰ ਕਿਆ ਕੁਛ ਖਾਣਾ ਕਿਆ ਨਹੀਂ ਅਤੇ ਮੈਂ ਇੱਕ ਚੀਜ਼ ਹੋਰ ਪੁੱਛਣੀ ਤੀ ਜੀ ਮੈਂ ਕਿਆ ਵੀ ਰਨਿੰਗ ਰੂਨਿੰਗ ਕਿੱਦਾਂ ਕਰਾਉਨੇ ਹੋ ਉੱਥੇ ਤੁਸੀਂ ਟ੍ਰੇਨਰ ਰੱਖਿਆ ਹੋਇਆ ਕੋਈ ਜਾਂ ਮਤਲਬ ਤੁਸੀਂ ਆਪ ਹੁੰਦੇ ਹੋ ਉੱਥੇ ਠੀਕ ਹੈ ਜੀ ਪਰ ਭਾਜੀ ਮੈਂ ਨਾ ਥੋਤੋਂ ਹੀ ਲੈਣੀ ਹੈ ਟ੍ਰੇਨਿੰਗ ਕਿਉਂਕਿ ਮੈਂ ਐਕਚੂਅਲੀ ਟ੍ਰੇਨਰਾਂ 'ਤੇ ਐਡਾ ਜਿੰਨਾ ਭਰੋਸਾ ਕਰਦਾ ਨਹੀਂ ਜਿੱਦਾਂ ਕਿ ਮੈਂ ਤੁਹਾਡੇ ਨਾਲ ਜ਼ਿਆਦਾ ਟ੍ਰੇਨਿੰਗ ਕਰਨਾ ਚਾਹੁੰਦਾ ਜੀ ਚਲੋ ਠੀਕ ਹੈ ਭਾਜੀ ਕੋਈ ਗੱਲ ਨਹੀਂ ਮੈਂ ਜਿੱਦਾਂ ਡਿਸਕਸ ਕਰਕੇ ਤੁਹਾਨੂੰ ਦੱਸਾਂਗਾ ਜੀ ਉਕੇ ਉਕੇ ਥੈਂਕ ਯੂ ਭਾਜੀ